ਵੈਸੇ ਤਾਂ ਇਹੋ ਜਿਹੀ ਕੋਈ ਕਿਤਾਬ ਹੈ ਨਹੀਂ ਬਟ ਹਾਂ ਸਬਜੈਕਟ ਬਾਰੇ ਜ਼ਰੂਰ ਗੱਲ ਸਕਦੀ ਆ ਗੱਲ ਕਰ ਸਕਦੀ ਹਾਂ ਕਿਉਂਕਿ ਜਦੋਂ ਵੀ ਕੋਈ ਮੈਨੂੰ ਸੁਜੈਸਟ ਕਰਦਾ ਸੀਗਾ ਕਿ ਹਿਸਟਰੀ ਜਿਹੜਾ ਉਹ ਇੱਕ ਬਹੁਤ ਵਧੀਆ ਸਬਜੈਕਟ ਹੈ ਉਸਨੂੰ ਪੜਨਾ ਚਾਹੀਦਾ ਔਰ ਉਸ ਦੇ ਵਿੱਚ ਬੜੀ ਨੌਲੇਜ ਮਿਲਦੀ ਹੈ ਤੁਹਾਨੂੰ ਬਟ ਜਿੰਨੀ ਵਾਰੀ ਵੀ ਮੈਂ ਹਿਸਟਰੀ ਦੀਆਂ ਕਿਤਾਬਾਂ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਤਾਂ ਮੈਨੂੰ ਬਹੁਤ ਬੋਰਿੰਗ ਲੱਗੀਆਂ ਨੇ ਕਿਉਂਕਿ ਕੋਈ ਕਦੋਂ ਮਰ ਗਿਆ ਕਦੋਂ ਜੀ ਪਿਆ ਤਾਂ ਮੈਨੂੰ ਇਹ ਬਹੁਤ ਇਲੋਜੀਕਲ ਜਿਹੀਆਂ ਗੱਲਾਂ ਲੱਗਦੀਆਂ ਨੇ ਕਿ ਉਹਦੇ ਬਾਰੇ ਅਸੀਂ ਪੜ੍ਹ ਕੇ ਕੀ ਲੈਣਾ ਬਟ ਹਾਂ ਅਗਰ ਆਪਣੇ ਐਜੂਕੇਸ਼ਨ ਸਿਸਟਮ ਦੇ ਵਿੱਚ ਇਹ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਇੱਕ ਅੱਛੇ ਤਰੀਕੇ ਦੇ ਨਾਲ ਉਹਨਾਂ ਨੂੰ ਰੈਦਰ ਦੈਨ ਕਿ ਉਹ ਕਦੋਂ ਜੰਮੇ ਕਦੋਂ ਮਰੇ ਕਿੰਨੀਆਂ ਲੜਾਈਆਂ ਕੀਤੀਆਂ ਦੇ ਨਾਲੋਂ ਅਗਰ ਉਹਨਾਂ ਦੇ ਕੀ ਖ਼ਾਸੀਅਤ ਸੀਗੀਆਂ ਉਹ ਉਹਨਾਂ ਬਾਰੇ ਦੱਸਿਆ ਜਾਵੇ ਜਾਂ ਜਿੱਦਾਂ ਬਾਬਰ ਹੈ ਹਿਮਾਯੂੰ ਹੈ ਕਿ ਇਹਨਾਂ ਦੀਆਂ ਕਿਹੜੀਆਂ ਖ਼ਾਸੀਅਤਾਂ ਸੀ ਜਿਸ ਦੇ ਕਰਕੇ ਇਹਨਾਂ ਨੇ ਇੰਨੀਆਂ ਬੈਟਲਸ ਵਿਨ ਕੀਤੀਆਂ ਜਾਂ ਇਹ ਰਾਜੇ ਕਿਉਂ ਬਣੇ ਸੀ ਤਾਂ ਉਹ ਅਗਰ ਦੱਸਿਆ ਜਾਵੇ ਤਾਂ ਉਹ ਜ਼ਿਆਦਾ ਵੈਲੂਏਬਲ ਹੋਵੇਗਾ ਨਹੀਂ ਤਾਂ ਅਦਰਵਾਈਜ ਮੈਨੂੰ ਕਦੇ ਵੀ ਹਿਸਟਰੀ ਸਬਜੈਕਟ ਪਸੰਦ ਨਹੀਂ ਆਇਆ ਹੈਗਾ ਔਰ ਬਹੁਤ ਬੋਰਿੰਗ ਲੱਗਦਾ ਸੀਗਾ ਜਦੋਂ ਵੀ ਪੜ੍ਹਨਾ ਸ਼ੁਰੂ ਕਰੋ ਅਤੇ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਸੀਗੀ ਤਾਂ ਕਿਤਾਬ ਤਾਂ ਨਹੀਂ ਕਹਿ ਸਕਦੇ ਬਟ ਹਾਂ ਸਬਜੈਕਟ ਕਹਿ ਸਕਦੇ ਹਾਂ ਕਿਤਾਬ ਐਜ਼ ਸਚ ਮੈਨੂੰ ਕਿਸੇ ਨੇ ਰੈਫਰ ਕੀਤੀ ਨਹੀਂ ਹੈ ਜਿਹੜੀ ਮੈਨੂੰ ਨਾ ਪਸੰਦ ਆਈ ਹੋਵੇ ਤਾਂ ਇੰਨਾ ਹੀ ਕਹਿਣਾ ਚਾਹਾਂਗੀ ਕਿ ਸਬਜੈਕਟ ਨਹੀਂ ਮੈਨੂੰ ਪਸੰਦ ਆਇਆ ਹੈਗਾ ਹਿਸਟਰੀ